ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਨਿਧੀ ਹੈ ਔਰ ਮੈਂ ਅੱਜ ਤੁਹਾਡੇ ਨਾਲ ਯੋਗਾ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਯੋਗਾ ਕਰਨ ਨਾਲ ਸਾਡੀ ਸਿਹਤ ਬਹੁਤ ਵਧੀਆ ਰਹਿੰਦੀ ਹੈ ਅਤੇ ਮਾਨਸਿਕ ਤੌਰ 'ਤੇ ਤਾਂ ਵਧੀਆ ਰਹਿੰਦੇ ਹਾਂ ਯੋਗਾ ਕਰਨ ਨਾਲ ਸਾਨੂੰ ਹਾਜਮੇ ਦੇ ਰਿਲੇਟਡ ਬਿਮਾਰੀਆਂ ਨਹੀਂ ਲੱਗਦੀਆਂ ਐਸੀਡੀਟੀ ਤੋਂ ਦੂਰ ਰਹਿੰਦੇ ਹਾਂ ਅਤੇ ਮੈਂਟਲ ਸਟਰੈਸ ਤੋਂ ਦੂਰ ਰਹਿੰਦੇ ਹਾਂ ਸਾਡਾ ਮੈਂਟਲ ਸਟਰੈਸ ਘੱਟ ਹੋ ਜਾਂਦਾ ਹੈ ਯੋਗਾ ਕਰਨ ਨਾਲ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਸਾਡੀ ਟੈਨਸ਼ਨ ਘੱਟ ਹੋ ਜਾਂਦੀ ਹੈ

ਹਾਜਮੇ 'ਚ ਵਿੱਚ ਮਦਦ ਕਰਦਾ ਹੈ ਔਰ ਸਾਨੂੰ ਬਚਪਨ ਤੋਂ ਹੀ ਯੋਗਾ ਕਰਨਾ ਚਾਹੀਦਾ ਹੈ ਜਿਹਦੇ ਨਾਲ ਸਾਡੀ ਸਿਹਤ ਵਧੀਆ ਤਰ੍ਹਾਂ ਨਾਲ ਫਲਦੀ ਫੁਲਦੀ ਹੈ ਮੈਂ ਖੁਦ ਸਵੇਰੇ ਉੱਠ ਕੇ ਯੋਗਾ ਕਰਦੀ ਹਾਂ ਅਤੇ ਸਾਰਾ ਦਿਨ ਉਸਦਾ ਫਾਇਦਾ ਲੈਂਦੀ ਹਾਂ ਜਿਹਦੇ ਨਾਲ ਮੈਨੂੰ ਫਰੈਸ਼ ਫੀਲ ਹੁੰਦਾ ਹੈ ਮੈਂ ਇੱਕ ਦਿਨ ਬਿਮਾਰ ਸੀ ਮੈਂ ਆਪਣਾ ਅਨੁਭਵ ਸਰੀਰਿਕ ਅਤੇ ਮਾਨਸਿਕ ਚੁਣੌਤੀਆਂ ਦਾ ਅਨੁਭਵ ਸਾਂਝਾ ਕਰ ਰਹੀ ਹਾਂ ਮੈਂ ਇੱਕ ਦਿਨ ਬਿਮਾਰ ਸੀ ਅਤੇ ਮੈਂ ਯੋਗਾ ਕਰ ਰਹੀ ਸੀ ਮੈਂ ਮੈਂਟਲੀ ਵੀ ਥੋੜ੍ਹੀ ਟੈਨਸ਼ਨ 'ਚ ਹੀ ਸੀ ਜਿਹਦੇ ਕਰਕੇ ਮੈਨੂੰ ਯੋਗਾ ਕਰਨ 'ਚ ਬਹੁਤ ਪ੍ਰੋਬਲਮ ਆਉਂਦੀ ਸੀ ਅਤੇ ਫਿਰ ਵੀ ਮੈਂ ਆਪਣਾ ਮੈਂਟਲੀ ਸਟੇਜ ਬਣਾਈ ਰੱਖੀ ਕਿ ਮੈਂ ਯੋਗਾ ਕਰਨਾ ਹੈ ਅਤੇ ਇਸ ਕਰਕੇ ਫਿਰ ਉਹ ਹੌਲੀ ਹੌਲੀ ਵੀਕਨੈੱਸ ਦੂਰ ਹੁੰਦੀ ਗਈ ਜਦੋਂ ਆਪਾਂ ਆਪਣਾ ਮਨ ਬਣਾਇਆ ਹੋਇਆ ਹੈ ਅਤੇ ਸਾਨੂੰ ਕੰਮ ਕਰਨ ਵਿੱਚ ਕੋਈ ਔਖ ਨਹੀਂ ਹੁੰਦੀ ਹੈਗੀ ਅਗਰ ਆਪਣਾ ਮਾਨਸਿਕ ਤੌਰ 'ਤੇ ਸਟਰੋਂਗ ਹੋਈਏ ਅਤੇ ਸਾਨੂੰ ਕੋਈ ਵੀ ਬਿਮਾਰੀ ਰੋਕ ਨਹੀਂ ਸਕਦੀ ਆਪਣਾ ਟਾਰਗੈਟ ਪੂਰਾ ਕਰਨ ਤੋਂ ਯੋਗਾ ਕਰਨਾ ਬਹੁਤ ਵਧੀਆ ਗੱਲ ਹੈ